ਸਤਿ ਸ਼੍ਰੀ ਅਕਾਲ ਡਰਾਈਵਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਆਹ ਰਸਤੇ ਵਿੱਚ ਜਿਹੜੀ ਆਹ ਰੋਡ ਕੰਸਟਰਕਸ਼ਨ ਚੱਲ ਰਹੀ ਹੈ ਇਸਦੇ ਕਰਕੇ ਕਿਆ ਤੁਸੀਂ ਲੰਬਾ ਰਸਤਾ ਪਾਇਆ ਹੈ ਚਲੋ ਜੇ ਤੁਸੀਂ ਹੁਣ ਇੱਥੋਂ ਲੰਬਾ ਰਸਤਾ ਪਾ ਹੀ ਲਿਆ ਹੈ ਤਾਂ ਮੈਨੂੰ ਦੱਸ ਦਿਉ ਕਿ ਸਾਨੂੰ ਏਅਰਪੋਰਟ ਪਹੁੰਚਣ ਤੱਕ ਕਿੰਨਾ ਟਾਈਮ ਲੱਗੇਗਾ ਕਿਉਂਕਿ ਮੈਂ ਉੱਥੇ ਅੱਠ ਵਜੇ ਤੱਕ ਪਹੁੰਚਣਾ ਹੈ ਉੱਥੇ ਸਾਰੇ ਰਿਸ਼ਤੇਦਾਰ ਮੇਰਾ ਇੰਤਜ਼ਾਰ ਕਰ ਰਹੇ ਹਨ ਅਤੇ ਦੋ ਘੰਟੇ ਪਹਿਲਾਂ ਮੈਂ ਉੱਥੇ ਪਹੁੰਚਣਾ ਚਾਹੁੰਦੀ ਹਾਂ ਤਾਂ ਕਿ ਮੈਂ ਉਹਨਾਂ ਨਾਲ ਚੰਗੀ ਤਰ੍ਹਾਂ ਮਿਲ ਸਕਾਂ ਅਤੇ ਫਿਰ ਆਪਣੀ ਫਲਾਈਟ ਜੋ ਹੈ ਚੜ੍ਹ ਸਕਾਂ ਅਤੇ ਅੱਗੇ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਤੁਸੀਂ ਜੋ ਹੈ ਕਿਸਤ ਕੋਈ ਵਧੀਆ ਰੈਸਟੋਰੈਂਟ ਦੇਖ ਕੇ ਉੱਥੇ ਜਿਹੜੀ ਹੈ ਕੈਬ ਰੋਕ ਲਿਓ ਤਾਂ ਕਿ ਮੈਂ ਫਰੈਸ਼ ਹੋ ਲਵਾਂ ਅਤੇ ਕੁਛ ਖਾ ਪੀ ਲਵਾਂ ਤੁਸੀਂ ਵੀ ਕਾਫੀ ਦੇਰ ਤੋਂ ਡਰਾਈਵ ਕਰ ਰਹੇ ਹੋ ਤਾਂ ਤੁਸੀਂ ਵੀ ਕੁਛ ਖਾ ਲਿਓ ਅਤੇ ਜੋ ਹੈ ਅਸੀਂ ਫਰੈਸ਼ ਫਰੁੱਸ਼ ਹੋ ਕੇ ਆਪਣਾ ਖਾ ਪੀ ਕੇ ਅੱਗੇ ਏਅਰਪੋਰਟ ਤੱਕ ਜਾਵਾਂਗੇ ਅਤੇ ਮੈਂ ਉੱਥੇ ਮਿਲ ਕੇ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਫਲਾਈਟ ਜੋ ਹੈ ਮੈਂ ਚੜ੍ਹ ਜਾਂ ਅਤੇ ਬਸ ਧੰਨਵਾਦ ਤੁਹਾਡਾ